ਕਾਰੋਬਰ ਸ਼ੁਰੂ ਕਰਦੇ ਸਮੇਂ ਪੇਂਡੂ ਲੋਕਾਂ ਨੂੰ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਜਦੋਂ ਵੀ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ ਆਪਣੇ ਬਿਜ਼ਨਸ ਦੇ ਨਾਲ ਦੀ ਤਾਂ ਉਹਨਾਂ ਨੂੰ ਸ਼ਹਿਰ ਵੱਲ ਜਾਣਾ ਪੈਂਦਾ ਹੈ ਕੋਈ ਵੀ ਛੋਟੀ ਤੋਂ ਛੋਟੀ ਚੀਜ਼ ਉਹਨਾਂ ਨੂੰ ਸ਼ਹਿਰ ਵੱਲੋਂ ਜਾਣ ਨੂੰ ਮਬੂਜ਼ਰ ਕਰਦੀ ਹੈ ਲੋਕਾਂ ਸਰਕਾਰ ਨੂੰ ਮਿਲ ਕੇ ਇਸ ਨੂੰ ਸ ਸਹੀ ਕਰਨਾ ਚਾਹੀਦਾ ਪਿੰਡਾਂ ਦੇ ਇਲਾਕਿਆਂ ਨੂੰ ਵਿਕਸਿਤ ਕਰਨਾ ਚਾਹੀਦਾ ਹੈ